ਪੰਜਾਬੀ ਭਾਸ਼ਾ ਸਾਨੂੰ ਅਮੀਰ ਵਿਰਸੇ ਵਿੱਚ ਮਿਲੀ ਹੈ ਇਹ ਬਾਕੀ ਭਾਸ਼ਾ ਨਾਲੋਂ ਛੋਟੀ ਦਿਖਾਈ ਗਈ ਹੈ ਜਿਵੇਂ ਬਾਹਰ ਜਾਣਾ ਹੋਵੇ ਬੱਚੇ ਨੇ ਉਸਨੂੰ ਅੰਗਰੇਜ਼ੀ ਸਿੱਖਣੀ ਪੈਂਦੀ ਹੈ ਤਾਂ ਉਹ ਬੱਚੇ ਨੇ ਜੋ ਅੰਗਰੇਜ਼ੀ 'ਤੇ ਹੀ ਜ਼ੋਰ ਦਿੰਦੇ ਨੇ ਤਾਂ ਇਹ ਸਾਡੀ ਪੰਜਾਬੀ ਭਾਸ਼ਾ ਜੋ ਸਕੂਲਾਂ ਵਿੱਚ ਵੀ ਲਾਗੂ ਨਹੀਂ ਕੀਤੀ ਗਈ ਬਹੁਤ ਸਕੂਲਾਂ ਵਿੱਚ ਜਿਵੇਂ ਉਹਨਾਂ ਬੱਚਿਆਂ ਨੂੰ ਪੰਜਾਬੀ ਬੋਲਣ ਦੇ ਫਾਇਨ ਵੀ ਕੀਤੇ ਜਾਂਦਾ ਹੈ ਪਰ ਸਰਕਾਰ ਨੇ ਇਸ ਨੂੰ ਉੱਪਰ ਚੁੱਕਣ ਲਈ ਹਰ ਸਕੂਲ ਦੇ ਵਿੱਚ ਜ਼ਰੂਰੀ ਲਾਗੂ ਕੀਤਾ ਗਿਆ ਕਿ ਏ ਕਿ ਪੰਜਾਬੀ ਭਾਸ਼ਾ ਲਾਜ਼ਮੀ ਬੋਲੀ ਜਾਵੇ ਪਰ ਇਹ ਸਾਨੂੰ ਭਾਸ਼ਾ ਪੰਜਾਬੀ ਮ ਅਮੀਰ ਵਿਰਸੇ ਵਿੱਚ ਮਿਲੀ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਗੁਰਮੁਖ ਲਿਪੀ ਵਿੱਚ ਲਿਖਿਆ ਗਏ ਹਨ ਸਾਡੇ ਗੁਰੂਆਂ ਦੀਆਂ ਲਿਖੀਆਂ ਰਚਨਾ ਵੀ ਪੰਜਾਬੀ ਵਿੱਚ ਹਨ